ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਜੀ ਦੱਸੋ ਤੁਹਾਡਾ ਕੰਮ ਕਾਰ ਕਿਵੇਂ ਚੱਲੀ ਜਾਂਦਾ ਜੀ ਵੈਸੇ ਮੈਂ ਇਹਨਾਂ ਚੀਜ਼ਾਂ ਬਾਰੇ ਰਿਸਰਚ ਕੀਤਾ ਸੀ ਦੋ ਤਿੰਨ ਅਕੈਡਮੀਆਂ ਮੈਨੂੰ ਵਧੀਆ ਲੱਗੀਆਂ ਅਤੇ ਉੱਥੇ ਥੋੜ੍ਹਾ ਟਾਈਮ ਵੀ ਸੇਵ ਹੋ ਜਾਂਦਾ ਅਤੇ ਮਨੀ ਵੀ ਸੇਵ ਕਰਨ ਵਾਲਾ ਕੰਮ ਵੀ ਹੈ ਅਤੇ ਉੱਥੋਂ ਦੇ ਕਈ ਪਲੇਅਰ ਕਾਮਯਾਬ ਹੋਏ ਨੇ ਕਈਆਂ ਦਾ ਨਾਮ ਇੰਟਰਨੈਸ਼ਨਲ ਪਲੇਅਰ ਵਿੱਚ ਆਉਂਦਾ ਇਕ ਬਾਬਾ ਬੰਦਾ ਸਿੰਘ ਬਹਾਦਰ ਅਕੈਡਮੀ ਹੈ ਪਟਿਆਲਾ ਵਿੱਚ ਅਤੇ ਜੀ ਐੱਸ ਗਿੱਲ ਜੋ ਹੈਂਡਲ ਕਰ ਰਹੇ ਨੇ ਉਹ ਖੁਦ ਇੰਟਰਨੈਸ਼ਨਲ ਪਲੇਅਰ ਰਹੇ ਨੇ ਅਤੇ ਉਹਨਾਂ ਦਾ ਵੀ ਬਹੁਤ ਚੱਲਦਾ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਅਕੈਡਮੀ ਹੈਗੀ ਹੈ ਮਹਿੰਦਰ ਸਿੰਘ ਅਕੈਡਮੀ ਅਤੇ ਉਹ ਵੀ ਬਹੁਤ ਵਧੀਆ ਅਕੈਡਮੀ ਹੈ ਅਤੇ ਉੱਥੋਂ ਦੇ ਕੋਚ ਅਵਤਾਰ ਸਿੰਘ ਜੀ ਨੇ ਉਹ ਵੀ ਬਹੁਤ ਵਧੀਆ ਨੇ ਅਤੇ ਆਪਣੇ ਸਟੂਡੈਂਟ ਨੂੰ ਸਹੀ ਸਹੀ ਆਪਣੇ ਸਟੂਡੈਂਟ ਨੂੰ ਗਾਈਡ ਕਰਦੇ ਨੇ ਮੈਂ ਮਿਲਿਆ ਵੀ ਦੋ ਤਿੰਨ ਵਾਰੀ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਟਾਈਮ ਕੱਢ ਕੇ ਮੇਰੇ ਕੋਲ ਮਿਲ ਜਿਓ ਮੈਨੂੰ ਆ ਕੇ ਮੈਂ ਤੁਹਾਨੂੰ ਨੌਲੇਜ ਪ੍ਰੋਵਾਈਡ ਕਰਵਾ ਦਾਂਗਾ ਜੇ ਵਧੀਆ ਲੱਗਾ ਇੱਥੇ ਐਡਮਿਸ਼ਨ ਲੈ ਲਿਓ ਨਹੀਂ ਤਾਂ ਕਿਤੇ ਹੋਰ ਅਕੈਡਮੀ ਕਹਿੰਦੇ ਮੇਰੇ ਜਾਣ ਪਛਾਣ ਦੀਆਂ ਹੈਗੀਆਂ ਵਧੀਆ ਇਸ ਤੋਂ ਵੀ ਵੱਡੀਆਂ ਅਕੈਡਮੀਆਂ ਅਸੀਂ ਉੱਥੇ ਤੁਹਾਡੀ ਐਡਮਿਸ਼ਨ ਕਰਵਾ ਦਾਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਉੱਥੇ ਕੋਈ ਦਿੱਕਤ ਨਹੀਂ ਆਉਂਦੀ ਅਕੈਡਮੀ ਬਹੁਤ ਵਧੀਆ ਉੱਥੋਂ ਦੇ ਕੋਚ ਵੀ ਬਹੁਤ ਵਧੀਆ ਨੇ ਗੁਰਸ਼ਰਨ ਸਿੰਘ ਗਿੱਲ ਉਹ ਵੀ ਇੰਟਰਨੈਸ਼ਨਲ ਪਲੇਅਰ ਨੇ ਉਹਨਾਂ ਨੇ ਆਪਣੇ ਟਾਈਮ 'ਚ ਬਹੁਤ ਤਰੱਕੀ ਕੀਤੀ ਏ ਉਹ ਮੇਰੇ ਮੇਰੇ ਵੀ ਕੋਚ ਰਹੇ ਨੇ ਉਹ ਥ ਥੋੜ੍ਹਾ ਟਾਈਮ ਉਹਨਾਂ ਤੋਂ ਮੈਂ ਵੀ ਸਿੱਖਿਆ ਹੋਇਆ ਹਾਂਜੀ

ਹਾਂਜੀ ਹਾਂਜੀ ਫਿਰ ਆਪਾਂ ਟਾਈਮ ਕੱਢ ਕੇ ਮੈਂ ਉਹਨਾਂ ਨੂੰ ਕੋਲ ਕਰ ਦਾਂਗਾ ਤੁਹਾਨੂੰ ਕੋਲ ਕਰਕੇ ਦੱਸ ਦਾਂਗਾ ਫਿਰ ਆਪਾਂ ਮਿਲਦੇ ਹਾਂ ਅਕੈਡਮੀ ਦੇ ਵਿੱਚ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਅਕੈਡਮੀ 'ਚ ਮਿਲਦੇ ਹਾਂ ਤੁਹਾਨੂੰ ਫੋਨ ਕਰਾਂਗਾ ਠੀਕ ਹੈ ਜੀ ਠੀਕ ਏ ਸਤਿ ਸ਼੍ਰੀ ਅਕਾਲ